ਜਦੋਂ ਮੇਰੇ ਕੋਲ ਬ੍ਰੇਕਫਾਸਟ ਬਣਾਉਣ ਦਾ ਟਾਈਮ ਨਹੀਂ ਹੁੰਦਾ ਤਾਂ ਮੈਂ ਦਲੀਆ ਜਾਂ ਓਟਸ ਬਣਾਉਣਾ ਪ੍ਰੈਫਰ ਕਰਦੀ ਹਾਂ ਜਾਂ ਫਿਰ ਬ੍ਰੈੱਡ ਨੂੰ ਤਲਕੇ ਉਹਦਾ ਬ੍ਰੇਕਫਾਸਟ ਕਰਦੀ ਹਾਂ ਜਾਂ ਫਿਰ ਦੁੱਧ ਦੇ ਵਿੱਚ ਮੁਸਲੀ ਪਾ ਕੇ ਖਾ ਲੈਂਦੀ ਹਾਂ ਅਤੇ ਜਾਂ ਫਿਰ ਐੱਗ ਬੋਇਲ ਕਰਕੇ ਖਾ ਲੈਂਦੀ ਹਾਂ ਜਾਂ ਸੇਵੀਆਂ ਦੀ ਵੀ ਵਰਤੋਂ ਕਰ ਲੈਂਦੀ ਹਾਂ